ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਜੀ ਹੋਰ ਸਭ ਵਧੀਆ ਜੀ ਮੇਰਾ ਹਾਲ ਭਾਅ ਜੀ ਬੜਾ ਖ਼ਰਾਬ ਹੈ ਜੀ ਮੈਂ ਭਾਅ ਜੀ ਤੁਹਾਡੇ ਤੋਂ ਪੰਦਰਾਂ ਤੋਂ ਵੀਹ ਦਿਨ ਪਹਿਲਾਂ ਤੁਹਾਡੇ ਤੋਂ ਮੈਂ ਕਿਤਾਬਾਂ ਆਰਡਰ ਕੀਤੀਆਂ ਸੀਗੀਆਂ ਤਿੰਨ ਚਾਰ ਕਿਤਾਬਾਂ ਆਰਡਰ ਕੀਤੀਆਂ ਸੀਗੀਆਂ ਉਹਦੇ ਭਾਅ ਜੀ ਜਿਹੜੀ ਤੁਸੀਂ ਕੁਆ ਜਿਹੜੀ ਤੁਸੀਂ ਕੁਆਲਿਟੀ ਜਾਂ ਫਿਰ ਜਿਹੜਾ ਮਟੀਰੀਅਲ ਤੁਸੀਂ ਆਨਲਾਈਨ ਦੱਸਿਆ ਹੋਇਆ ਸੀਗਾ ਉਹ ਭਾਅ ਜੀ ਉਹਦੇ ਵਿੱਚ ਕੁਛ ਵੀ ਨਹੀਂ ਸੀਗਾ ਉਹਦੇ ਨਾਲੇ ਇਹਦੇ 'ਚ ਕਾਫੀ ਫਰਕ ਸੀਗਾ ਅਤੇ ਜਿਹੜੇ ਇਹਦੀ ਜਿਹੜੇ ਉਹਦੀ ਸਾਰਿਆਂ ਨਾਲੋਂ ਬੜੇ ਮੇਨ ਰੀਜ਼ਨ ਸੀਗੇ ਅਤੇ ਕੁਆਲਟੀ ਅਤੇ ਨੰਬਰ ਦੋ 'ਤੇ ਉਹਦੇ ਜਿਹੜੀ ਉਹਦੀ ਪੈਕੇਜਿੰਗ ਕੁਆਲਿਟੀ ਸੀਗੀ ਉਹ ਵੀ ਕਾਫੀ ਘਟੀਆ ਸੀਗੀ ਪੇਜ ਦੀ ਤਾਂ ਭਾਅ ਜੀ ਤੁਸੀਂ ਗੱਲ ਹੀ ਛੱਡ ਦਿਉ ਉਹਦੀ ਇੰਨੀ ਰੰਗ ਢੰਗ ਇੰਨਾ ਮਾੜਾ ਸੀਗਾ ਉਹਦੇ ਦੋ ਤੋਂ ਚਾਰ ਦਿਨ ਵਿੱਚ ਹੀ ਫੱਟ ਗਏ ਸਾਰੇ ਉਹ ਇੱਕ ਦੋ ਤਾਂ ਪਹਿਲਾਂ ਹੀ ਫਟੀਆਂ ਨਿਕਲੀਆਂ ਬੁੱ ਕਿਤਾਬਾਂ ਨਾ ਉਹਦੇ ਵਿੱਚ ਮਟੀਰੀਅਲ ਚੱਜ ਦਾ ਸੀਗਾ ਨਾ ਹੋਰ ਕੁਛ ਭਾਅ ਜੀ ਵਧੀਆ ਸੀਗਾ ਉਹਦੇ ਵਿੱਚ ਮੈਂ ਤਾਂ ਭਾਅ ਜੀ ਫਸ ਗਿਆ ਤੁਹਾਡੇ ਕੋਲ ਆ ਕੇ